ਬਾਲ ਮਜ਼ਦੂਰੀ ਇਸ ਸਮਾਜ ਦੀ ਬਹੁਤ ਹੀ ਜ਼ਿਆਦਾ ਸ ਸਮਾਜਿਕ ਬਹੁਤ ਹੀ ਇੱਕ ਸ ਸਮਾਜਿਕ ਬੁਰਾਈ ਹੈ ਜੋ ਕਿ ਬੱਚਿਆਂ ਦੇ ਭਵਿੱਖ ਨੂੰ ਬਰਬਾਦ ਕਰਦੀ ਆ ਅਤੇ ਉਹਨਾਂ ਦੇ ਬਚਪਨ ਨੂੰ ਵੀ ਖੋਹ ਲੈਂਦੀ ਆ ਅਤੇ ਇਸ ਨੂੰ ਰੋਕਣ ਦੇ ਲਈ ਬਹੁਤ ਸਾਰੀਆਂ ਕਾਨੂੰਨੀ ਵਿਵਸਥਾ ਕੀਤੀਆਂ ਗਈਆਂ ਹਨ ਜਿਵੇਂ ਕਿ ਬਹੁਤ ਸਾਰੇ ਐਕਟ ਵੀ ਬਣਾਏ ਗਏ ਹਨ ਸੰਵਿਧਾਨ ਦੇ ਵਿੱਚ ਅਤੇ ਸੰਵਿਧਾਨ ਵਿੱਚ ਇੱਕ ਐਕਟ ਹੈ ਜਿਸ ਦੇ ਅਕੋਰਡਿੰਗ ਚੌਦਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਕੰਮ ਵਿੱਚ ਲਗਾਉਣ 'ਤੇ ਪਾਬੰਦੀ ਲਗਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟ ਬਣਾਏ ਗਏ ਹਨ ਜਿਵੇਂ ਕਿ ਕਿਸੇ ਫੈਕਟਰੀ 'ਚ ਕੰਮ ਕਰਨਾ ਕਿਸੇ ਹੋਰ ਖਤਰਨਾਕ ਜਗ੍ਹਾ ਵਿੱਚ ਕੰਮ ਕਰਨ ਤੋਂ ਮਨਾਹੀ ਕੀਤੀ ਜਾਂਦੀ ਆ ਅਤੇ ਇਸ ਤੋਂ ਇਲਾਵਾ ਪਿੰਡ ਪੱਧਰ 'ਤੇ ਵੀ ਕਾਫੀ ਵਿਵਸਥਾਵਾਂ ਕੀਤੀਆਂ ਜਾਂਦੀਆਂ ਹਨ ਇਹ ਪਿੰਡ ਪੱਧਰ 'ਤੇ ਵੀ ਲੋਕਾਂ ਨੂੰ ਬਾਲ ਮ ਮਜ਼ਦੂਰੀ ਦੇ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ ਲੋਕਾਂ ਵਿੱਚ ਜੇਕਰ ਕੋਈ ਵਿਅਕਤੀ ਏ ਬ ਬਾਲ ਮਜ਼ਦੂਰੀ ਕਰਦਾ ਹੈ ਅਤੇ ਪਿੰਡ ਦੀ ਪੰਚਾਇਤ ਉਹਨਾਂ 'ਤੇ ਨਜ਼ਰ ਰੱਖਦੀ ਆ ਅਤੇ ਅਤੇ ਸਿੱਖਿਆ ਵਿਭਾਗ ਵਿੱਚ ਵੀ ਸ ਸਿੱਖਿਆ ਵਿਭਾਗ ਵਾਲੇ ਵੀ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਹਨ ਅਤੇ ਉਹ ਲੋਕਾਂ ਨੂੰ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਜਾਗਰੂਕ ਕਰਦੇ ਹਨ ਅਤੇ ਇੱਦਾਂ ਦੀ ਹੀ ਇੱਕ ਘਟਨਾ ਮੇਰੇ ਪਿੰਡ ਵਿੱਚ ਸੀਗੀ ਮੇਰੇ ਪਿੰਡ ਵਿੱਚ ਇੱਕ ਦਸ ਸਾਲ ਦਾ ਬੱਚਾ ਸੀਗਾ ਜਿਹੜਾ ਕਿ ਢਾਬੇ 'ਤੇ ਕੰਮ ਕਰਦਾ ਸੀ ਕਿਉਂਕਿ ਉਹ ਘਰੋਂ ਬਹੁਤ ਗਰੀਬ ਸੀ ਉਹ ਸਾਰਾ ਦਿਨ ਪਿੰਡ ਵਿੱਚ ਭਾਂਡੇ ਮਾਂਜ ਢਾਬੇ 'ਤੇ ਭਾਂਡੇ ਮਾਂਜਦਾ ਸੀਗਾ ਅਤੇ ਗਾਹਕਾਂ ਨੂੰ ਚਾਹ ਪਾਣੀ ਪਿਲਾਉਂਦਾ ਸੀਗਾ ਅਤੇ ਉਸਦੇ ਮਾਪੇ ਇੰਨੇ ਜ਼ਿਆਦਾ ਗਰੀਬ ਸਨ ਕਿਉਂਕਿ ਉਹਨਾਂ ਕੋਲ ਕੋਈ ਹੋਰ ਚਾਰਾਂ ਨਹੀਂ ਸੀ ਅਤੇ ਜਦੋਂ ਇਸ ਦੀ ਘਟਨਾ ਸਾਡੇ ਪਿੰਡ ਦੇ ਸਰਪੰਚ ਨੂੰ ਪਤਾ ਲੱਗੀ ਜਾਂ ਹੋਰ ਲੋਕਾਂ ਨੂੰ ਪਤਾ ਲੱਗੀ ਤਾਂ ਫਿਰ ਸਰਪੰਚ ਨੇ ਇਸ ਚੀਜ਼ 'ਤੇ ਐਕਸ਼ਨ ਲਿਆ ਅਤੇ ਉਹਨਾਂ ਨੇ ਉਸ ਬੱਚੇ ਨੂੰ ਹਟਾ ਲਿਆ ਅਤੇ ਉਸ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਧੰਨਵਾਦ